ਆਧੁ ਆਧੁਨਿਕਤਾ ਦੀ ਗੱਲ ਕਰੀਏ ਜੀ ਤਾਂ ਵਿਸ਼ਵ ਦੇ ਨਕਸ਼ੇ ਦੇ ਉੱਤੇ ਪੰਜਾਬੀ ਹਮੇਸ਼ਾ ਹੀ ਚਰਚਾ 'ਚ ਰਹੇ ਨੇ ਅਤੇ ਚਾਹੇ ਉਹ ਖਾਣ ਦੀਆਂ ਆਦਤਾਂ ਹੋਣ ਚਾਹੇ ਉਹ ਆਪਣਾ ਗੁਰਪੁਰਬ ਮਨਾਉਣ ਦੀਆਂ ਹੋਣ ਚਾਹੇ ਉਹ ਖੁਸ਼ੀ ਦਾ ਮੌਕਾ ਹੋਵੇ ਅਤੇ ਪੰਜਾਬੀਆਂ ਨੇ ਅੱਜ ਦੇ ਟੈਮ ਦੇ ਵਿੱਚ ਵੀ ਜਿਹੜੀਆਂ ਆਪਣੀਆਂ ਖਾਣ ਦੀਆਂ ਆਦਤਾਂ ਨਹੀਂ ਬਦਲੀਆਂ ਆਪਣੇ ਪਹਿਨਣ ਦੀਆਂ ਆਦਤਾਂ ਨਹੀਂ ਬਦਲੀਆਂ ਆਪਣੀਆਂ ਜਿਹੜੀਆਂ ਨਾਚ ਗਾਣੇ ਨੇ ਉਹ ਹਮੇਸ਼ਾ ਤੋਂ ਹੀ ਪੰਜਾ ਵਿਸ਼ਵ ਪੱਧਰ ਦੇ ਉੱਤੇ ਕਾਇਮ ਰੱਖੇ ਨੇ ਕਿਉਂਕਿ ਗਿੱਧਾ ਭੰਗੜਾ ਜਿਹੜਾ ਹੁਣ ਹੋਰ ਵੀ ਜ਼ਿਆਦਾ ਮਸ਼ਹੂਰ ਹੋ ਗਿਆ ਪੰਜਾਬੀਆਂ ਦੀ ਅੱਡ ਪਛਾਣ ਬਣ ਗਈ ਲੋਕ ਨਾਚ ਨੇ ਜਿਹੜੇ ਪੰਜਾਬੀ ਦੇ ਵਿਸ਼ਵ ਲੈਵਲ ਦੇ ਉੱਤੇ ਜਿਹੜੇ ਨੇ ਮਸ਼ਹੂਰ ਹੋਏ ਨੇ ਇਸੇ ਤਰ੍ਹਾਂ ਜਿਹੜਾ ਸਾਗ ਹੈ ਜਾਂ ਪੰਜਾਬੀ ਖਾਣਾ ਹੈ ਉਹ ਪੂਰੀ ਦੁਨੀਆਂ ਦੇ ਵਿੱਚ ਜਾਣਿਆ ਜਾਂਦਾ ਪੰਜਾਬੀਆਂ ਦੀ ਜਿਹੜੀ ਆਪਣੀ ਇੱਕ ਗੁਰਪੁਰਬ ਮਨਾਉਣ ਦਾ ਜਾਂ ਵਿਸਾਖੀ ਕਹਿ ਲਉ ਜਾਂ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ਼ ਮਨਾਇਆ ਜਾਂਦਾ ਜਿਹਦੇ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਅੱਜ ਦੇ ਟੈਮ 'ਚ ਵੀ ਸਾਡਾ ਸੱਭਿਆਚਾਰ ਉਸੇ ਤਰ੍ਹਾਂ ਕਾਇਮ ਆ